ਹਾਂਜੀ ਸਾਡਾ ਧ ਧਰਮ ਸਾਨੂੰ ਸਮਾਜ ਸੇਵਾ ਬਾਰੇ ਸਿਖਾਉਂਦਾ ਹੈ ਕਿਉਂਕਿ ਸਾਡਾ ਧਰਮ ਦੱਸਦਾ ਹੈ ਕਿ ਅਸੀਂ ਹਰ ਇੱਕ ਦੀ ਸੇਵਾ ਕਰਨੀ ਹੈ ਆਪਣਿਆਂ ਤੋਂ ਛੋਟੇ ਅਤੇ ਵੱਡਿਆਂ ਦਾ ਆਦਰ ਕਰਨਾ ਹੈ ਇਸ ਵਿੱਚ ਕਿ ਜਿਵੇਂ ਕਿ ਹੁਣ ਅੱਜ ਕੱਲ ਹੜ੍ਹ ਅਤੇ ਹੋਰ ਸਮੱਸਿਆਵਾਂ ਜਿਹੜੀਆਂ ਕਿ ਲੋਕਾਂ ਨੂੰ ਫੇਸ ਕਰਨੀਆਂ ਪੈਦੀਆਂ ਹਨ ਜਿਹੜੇ ਲੋਕ ਕੀ ਹੈ ਇਹਨਾਂ ਵਿੱਚੋਂ ਨਿਕਲ ਨਹੀਂ ਪਾਉਂਦੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਨ ਲੰਗਰ ਪਾਣੀ ਲਈ ਅਸੀਂ ਉਹਨਾਂ ਦੀ ਸੇਵਾ ਕਰਦੇ ਹਨ ਜ਼ਰੂਰਤ ਆ ਜੋ ਵੀ ਚੀਜ਼ਾਂ ਉਹਨਾਂ ਨੂੰ ਜ਼ਰੂਰੀ ਚਾਹੀਦੀਆਂ ਹਨ ਅਸੀਂ ਉਹ ਉਹਨਾਂ ਨੂੰ ਦਿੰਦੇ ਹਨ ਤਾਂ ਜੋ ਉਹ ਆਪਣਾ ਜੀਵਨ ਫਿਰ ਤੋਂ ਇੱਕ ਨਵੇਂ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ